ਹੈਲੋ ਹਾਂਜੀ ਪੀਜ਼ਾ ਲੈ ਕੇ ਆਏ ਭਾਅ ਜੀ ਵਧੀਆ ਵਧੀਆ ਯਾਰ ਪਜ਼ੀਰੀਆ ਕੰਪਨੀ ਦਾ ਪੀਜ਼ਾ ਮੰਗਵਾਇਆ ਤੁਹਾਡੇ ਕੋਲੋਂ ਅਤੇ ਐਤਕੀ ਬੜੇ ਟਾਈਮ ਨਾਲ ਤੁਸੀਂ ਪਹੁੰਚਾ ਤਾ ਯਾਰ ਵੈਰੀ ਗੁੱਡ ਬਹੁਤ ਅੱਛੀ ਗੱਲ ਹੈ ਯਾਰ ਟਾਈਮ ਸਿਰ ਚੀਜ਼ ਦਿੱਤੀ ਹੈ ਵੀ ਫਰੈਸ਼ ਬਿਲਕੁਲ ਲੱਗਦਾ ਚਲੋ ਵਧੀਆ ਗੱਲ ਹੈ ਸਹੀ ਤਰੀਕੇ ਨਾਲ ਕੰਮ ਕਰਿਆ ਕਰੋ ਕੰਪਨੀ ਵੀ ਵਧੀਆ ਕੰਮ ਕਰਦੀ ਹੈ ਵੈਸੇ ਵੀ ਪਜ਼ੀਰੀਆ ਦਾ ਕਾਫੀ ਅੰਮ੍ਰਿਤਸਰ 'ਚ ਅੱਛਾ ਨਾਂ ਹੈਗਾ ਵਧੀਆ ਤਰੀਕੇ ਨਾਲ ਯਾਰ ਤੁਸੀਂ ਕੰਮ ਕਰਦੇ ਪਏ ਜੇ ਗੁੱਡ ਆ ਮੈਨੂੰ ਅੱਛਾ ਲੱਗਾ ਉਹ ਪਿਛਲੀ ਵਾਰੀ ਤੁਹਾਡਾ ਥੋੜ੍ਹਾ ਲੇਟ ਸੀਗਾ ਐਤਕੀ ਤੁਸੀਂ ਆਰਡਰ ਬਿਲਕੁਲ ਟਾਈਮ 'ਤੇ ਲਿਆਂਦਾ ਹੈਗਾ ਕਮਾਲ ਹੋ ਗਈ ਯਾਰ ਕਿ ਘਰ ਛੇਤੀ ਲੱਭ ਗਿਆ ਸੀ ਆਰਾਮ ਨਾਲ ਓਕੇ ਗੂਗਲ ਮੈਪ ਰਾਹੀਂ ਤੁਸੀਂ ਆਏ ਓਕੇ ਓਕੇ ਅੱਛਾ ਲਾਸਟ ਟਾਈਮ ਹੀ ਤੁਹਾਨੂੰ ਯਾਦ ਸੀਗਾ ਵੀ ਕਿੱਧਰ ਆਉਣ ਕਿੱਧਰ ਨਹੀਂ ਆਉਣਾ ਤਾਂ ਹੀ ਲੱਭਣ ਲੱਗਿਆ ਟਾਈਮ ਨਹੀਂ ਲੱਗਿਆ ਨਹੀਂ ਨਹੀਂ ਠੀਕ ਹੈ ਠੀਕ ਹੈ ਚਲੋ ਅਗਲੀ ਵਾਰੀ ਵੀ ਕਦੋਂ ਤੇ ਟਾਈਮ ਨਾਲ ਜਦੋਂ ਤੁਹਾਨੂੰ ਕੋਈ ਵੀ ਅੋਰਡਰ ਕਰੀਏ ਉਸੇ ਹਿਸਾਬ ਨਾਲ ਤੁਸੀਂ ਆਜਿਆ ਕਰੋ ਯਾਰ ਠੀਕ ਹੈ ਨਹੀਂ ਨਹੀਂ ਇਹ ਹੈ ਵੀ ਵਧੀਆ ਲੱਗਾ ਮੈਨੂੰ ਯਾਰ ਕਿ ਵੀ ਉਸੇ ਵੇਲੇ ਤੁਸੀਂ ਅੋਡਰ ਸਾਡਾ ਲਿਆ ਅੋਡਰ ਲੈ ਕੇ ਟੈਮ ਸਿਰ ਆ ਗਏ ਪੰਦਰਾਂ ਮਿੰਟ ਦਾ ਟਾਈਮ ਦਿੰਦੇ ਪੰਦਰਾਂ ਮਿੰਟ ਤੋਂ ਹੀ ਪਹਿਲੀ ਵਾਰੀ ਆ ਗਏ ਯਾਰ ਮੈਂ ਤਾਂ ਹੈਰਾਨ ਏ ਇੰਨੀ ਛੇਤੀ ਤੁਸੀਂ ਕਿੱਦਾਂ ਆ ਗਏ ਜੇ ਚਲੋ ਅੱਛੀ ਗੱਲ ਹੈ ਯਾਰ ਨਹੀਂ ਨਹੀਂ ਕੰਪਨੀ ਤੁਹਾਡੀ ਦੀ ਯਾਰ ਕੁਆਲਿਟੀ ਅੱਛੀ ਹੁੰਦੀ ਆ ਵਧੀਆ ਲੱਗਦਾ ਤਾਂ ਹੀ ਤੁਹਾਡੇ ਕੋਲੋਂ ਮੰਗਵਾਈ ਦਾ ਵਾ ਹੋਰ ਵੀ ਇੱਥੇ ਇੰਨੀਆਂ ਕੰਪਨੀਆਂ ਉਹਨਾਂ ਤੋਂ ਕਿਉਂ ਨਹੀਂ ਅਸੀਂ ਅੋਡਰ ਦੇਈਦੇ ਤਾਂ ਹੀ ਤੁਹਾਨੂੰ ਦੇਈਦਾ ਵਾ ਵੈਸੇ ਵੀ ਤੁਹਾਡੇ ਉੱਥੇ ਆ ਕੇ ਖਾਈਦਾ ਦਫ਼ਤਰ ਤੁਹਾਡੇ ਜਿੱਥੇ ਤੁਹਾਡਾ ਰੈਸਟੋਰੈਂਟ ਵਧੀਆ ਬਣਾਇਆ ਵਿਆ ਰੈਸਟੋਰੈਂਟ ਵੀ ਅੱਛਾ ਤੁਹਾਡਾ ਜੋ ਕੁਆਲਿਟੀ ਤੁਹਾਡੇ ਰੈਸਟੋਰੈਂਟ 'ਚ ਮਿਲਦੀ ਆ ਆਲਮੋਸਟ ਉਹੀ ਆ ਸੇਮ ਹੈਗੀ ਆ ਹੋਮ ਡਿਲੀਵਰੀ ਵੀ ਠੀਕ ਆ ਟੇਸਟ ਵੀ ਠੀਕ ਆ ਵਧੀਆ ਚੀਜ਼ ਹੈ ਚਲੋ ਗੁੱਡ ਹੈ ਅਗਲੀ ਵਾਰੀ ਵੀ ਤੁਹਾਨੂੰ ਹੀ ਦਿਆਂਗੇ ਯਾਰ ਮੌਕਾ